ਇੱਕ ਜੀਰੋ ਪੰਜ ਤਿੰਨ ਛੇ ਜੀਰੋ ਨੌ ਇੱਕ ਚਾਰ ਜੀਰੋ ਛੇ ਪੰਜ ਚਾਰ ਪੰਜ ਚਾਰ ਛੇ ਜੀਰੋ ਚਾਰ ਨੌ ਸੱਤ ਜੀਰੋ ਜੀਰੋ ਇੱਕ ਜੀਰੋ ਜੀਰੋ ਸੱਤ ਛੇ ਇੱਕ